ਹਾਂਜੀ ਸਾਨੂੰ ਇਹ ਸਾਰਾ ਪੈਸਾ ਇੱਕੋ ਹੀ ਕਾਰੋਬਾਰ ਵਿੱਚ ਨਹੀਂ ਲਗਾਉਣਾ ਚਾਹੀਦਾ ਜਦੋਂ ਕਿ ਸਾਨੂੰ ਛੋਟੇ ਛੋਟੇ ਦੋ ਤਿੰਨ ਬਿਜਨਸ ਖੋਲ੍ਹਣੇ ਕਾਰੋਬਾਰ ਸ਼ੁਰੂ ਕਰਨੇ ਚਾਹੀਦੇ ਹਨ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਨੂੰ ਕਿਹੜੇ ਕਾਰੋਬਾਰ ਵਿੱਚ ਜ਼ਿਆਦਾ ਫਾਇਦਾ ਹੋ ਰਿਹਾ ਆ ਜਿੱਦਾਂ ਅਸੀਂ ਇੱਕ ਹੋਟਲ ਖੋਲ੍ਹਦੇ ਹਾਂ ਜੇ ਅਸੀਂ ਉਸ ਹੋਟਲ ਨੂੰ ਜ਼ਿਆਦਾ ਵੱਡਾ ਜਾਂ ਫਿਰ ਜ਼ਿਆਦਾ ਉਹਦੇ 'ਤੇ ਪੈਸਾ ਲਗਾ ਦਿੰਦੇ ਹਾਂ ਤਾਂ ਸਾਨੂੰ ਜੇ ਕੱਲ੍ਹ ਨੂੰ ਉਹ ਸਾਡਾ ਹੋਟਲ ਨਾ ਚੱਲੇ ਅਤੇ ਸਾਡਾ ਹੀ ਨੁਕਸਾਨ ਹੈ ਇਸ ਕਰਕੇ ਸਾਨੂੰ ਆਪਣੇ ਨੁਕਸਾਨ ਤੋਂ ਬਚਣ ਦੇ ਲਈ ਸਾਨੂੰ ਛੋਟੇ ਛੋਟੇ ਪਹਿਲਾਂ ਛੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੀਦਾ ਹੈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡਾ ਕਾਰੋਬਾਰ ਕਿੰਨਾ ਕੁ ਚੱਲ ਰਿਹਾ ਆ ਉਸ ਜਗ੍ਹਾ ਦੇ ਉੱਤੇ ਫਿਰ ਜੇ ਸਾਡਾ ਵਧੀਆ ਚੱਲ ਰਿਹਾ ਤਾਂ ਸਾਨੂੰ ਅੱਗੇ ਵਧਾਉਣਾ ਚਾਹੀਦਾ ਹੈ ਨਹੀਂ ਤਾਂ ਫਿਰ ਸਾਨੂੰ ਹੋਰ ਜਿਹੜਾ ਦੂਜਾ ਕਾਰੋਬਾਰ ਖੋਲ੍ਹਿਆ ਹੈ ਉਹਦੇ ਬਾਰੇ ਸੋਚਣਾ ਚਾਹੀਦਾ ਕਿ ਸਾਡਾ ਕਿਹੜਾ ਕਾਰੋਬਾਰ ਜ਼ਿਆਦਾ ਵਧੀਆ ਚੱਲ ਰਿਹਾ ਕਿ ਸਾਨੂੰ ਉਹਦੇ 'ਤੇ ਜ਼ਿਆਦਾ ਇਨਵੈਸਟਮੈਂਟ ਜ਼ਿਆਦਾ ਪੈਸਾ ਲਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਸਾਨੂੰ ਕਿਸੇ ਵੀ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ